ਅਸੀਂ ਜਿਹੜੇ ਜਿੱਦਾਂ ਦੇ ਏਰੀਏ 'ਚ ਰਹਿੰਦੇ ਆ ਉੱਥੇ ਜ਼ਿਆਦਾਤਰ ਸਰਦੀਆਂ ਵਗੈਰਾ ਦੇ ਮੌਸਮ 'ਚ ਉੱਨ ਵਗੈਰਾ ਦੀਆਂ ਚੀਜ਼ਾਂ ਕੋਟੀਆਂ ਵਗੈਰਾ ਬੁਣੀਆਂ ਜਾਂਦੀਆਂ ਨੇ ਸਵੈਟਰ ਵਗੈਰਾ ਬੁਣੇ ਜਾਂਦੇ ਨੇ ਅਤੇ ਸਿਲਾਈ ਜ਼ਿਆਦਾਤਰ ਸੂਟ ਪੰਜਾਬੀ ਵਗੈਰਾ ਪਾਏ ਜਾਂਦੇ ਨੇ ਅਤੇ ਜਿਸ ਹਿਸਾਬ ਨਾਲ ਇੰਡਸਟਰੀ ਏਰੀਆ ਹੈ ਇੱਥੇ ਦੀਆਂ ਯਾਨੀ ਕਿ ਅਮੀਰ ਜੇ ਔਰਤਾਂ ਨੇ ਉਹ ਜ਼ਿਆਦਾਤਰ ਸੋਹਣੇ ਸੋਹਣੇ ਵਧੀਆ ਵਧੀਆ ਸੂਟ ਹੀ ਸਿਲਾਈ ਕਰਵਾ ਕੇ ਪਾਉਣੇ ਹੀ ਪਸੰਦ ਕਰਦੇ ਨੇ ਅਤੇ ਫਿਰ ਮੈਂ ਉਹਨਾਂ ਦੇ ਸੂਟ ਵਗੈਰਾ ਵਧੀਆ ਸਿਊ ਕੇ ਦੇ ਕੇ ਉਹਨਾਂ ਤੋਂ ਵਧੀਆ ਪੈਸੇ ਵੀ ਲੈ ਲੈਂਦੀ ਹਾਂ ਜੇ ਕਿਸੇ ਨੂੰ ਕਾਹਲੀ ਹੁੰਦੀ ਹੈ ਐਮਰਜੰਸੀ ਸੂਟ ਸਿਊਣਾ ਹੁੰਦਾ ਤਾਂ ਵੀ ਮੈਂ ਯਾਨੀ ਕਿ ਜੋ ਜਿਹੜਾ ਵੀ ਕੋਈ ਕਸਟਮਰ ਪਹਿਲਾਂ ਸੂਟ ਲੈ ਕੇ ਆਉਂਦਾ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਵੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਹੀ ਸੂਟ ਬਣਾਵਾਂ ਫਿਰ ਮੈਂ ਵਿੱਚੋਂ ਟਾਈਮ ਕੱਢ ਕੇ ਯਾਨੀ ਕਿ ਦੂਸਰੇ ਦਾ ਵੀ ਕੰਮ ਜਲਦੀ ਤੋਂ ਜਲਦੀ ਅਤੇ ਵਧੀਆ ਢੰਗ ਨਾਲ ਕਰਕੇ ਦੇਣਾ ਹੀ ਪਸੰਦ ਕਰਦੀ ਹਾਂ ਅਤੇ ਮੈਨੂੰ ਵੈਸੇ ਖੁਦ ਆਪ ਨੂੰ ਜਿਵੇਂ ਪਲਾਜ਼ੋ ਵਗੈਰਾ ਇੱਦਾਂ ਦਾ ਟਰੈਂਡ ਦੇ ਹਿਸਾਬ ਨਾਲ ਕੱਪੜਾ ਲੀੜਾ ਪਾਉਣਾ ਪਸੰਦ ਆ ਪਰ ਸਿੰਪਲ ਸੋ ਵੈਸਟ ਤਾਂ ਮੈਂ ਜ਼ਿਆਦਾਤਰ ਸਿੰਪਲ ਕੱਪੜੇ ਹੀ ਪਾ ਕੇ ਰਾਜ਼ੀ ਹੁੰਦੀ